ਹੈਲੋ ਹਾਂਜੀ ਓਲਾ ਤੋਂ ਬੋਲਦੇ ਆ ਜੀ ਅੱਛਾ ਲਾਸਟ ਵੀਕ ਮੈਂ ਰਾਈਡ ਬੁੱਕ ਕੀਤੀ ਸੀਗੀ ਅਤੇ ਉਹ ਮੁੰਡਾ ਆਇਆ ਸੀਗਾ ਨਾਮ ਮਨਜਿੰਦਰ ਸੀਗਾ ਅਤੇ ਯਾਰ ਉਹ ਬੜਾ ਹਸਮੁਖ ਸੁਭਾਅ ਦਾ ਸੀਗਾ ਯਾਰ ਉਸਨੇ ਮੇਰਾ ਸਮਾਨ ਖ਼ੁਦ ਡਿੱਗੀ 'ਚੋਂ ਉਤਾਰਿਆ ਅਤੇ ਮੈਨੂੰ ਸਮੇਂ 'ਤੇ ਪਹੁੰਚਾ ਵੀ ਦਿੱਤਾ ਉਹਨੇ ਅਤੇ ਉਸਨੇ ਬੜੀ ਵਧੀਆ ਗੱਲਾਂ ਕੀਤੀਆ ਮੇਰੇ ਨਾਲ ਅਤੇ ਜੇ ਉਸਦੀ ਰੇਟਿੰਗ ਦੀ ਗੱਲ ਕਰੀਏ ਤਾਂ ਮਤਲਬ ਕਿ ਪੰਜ ਵਿੱਚੋਂ ਪੰਜ ਦੀ ਰੇਟਿੰਗ ਮੈਂ ਦਿੰਦਾ ਉਸਨੂੰ ਠੀਕ